ਵੈਸੇ ਤਾਂ ਅਗਰ ਗੱਲ ਕੀਤੀ ਜਾਵੇ ਆਉਣ ਵਾਲੇ ਜਿਹੜੇ ਟਾਇਮ ਦੇ ਗਾਇਕ ਅੱਜ ਕੱਲ ਕੋਈ ਵੀ ਗਾਇਕ ਬਣਦਾ ਜਾ ਰਿਹਾ ਹੈ ਜਿਵੇਂ ਕਿ ਉਹਨਾਂ ਦਾ ਕੋਈ ਵੀ ਕੋਈ ਅ ਸੁਰ ਉੱਪਰ ਥੱਲੇ ਹੋ ਜਾਂਦਾ ਹੈ ਕਈਆਂ ਦੀ ਆਵਾਜ਼ ਨਹੀਂ ਵਧੀਆ ਹੁੰਦੀ ਹੈ ਕਈਆਂ ਦਾ ਉੱਪਰ ਥੱਲੇ ਹੋ ਜਾਂਦਾ ਹੈ ਕੋਈ ਕੋਈ ਆਪਾਂ ਇੰਸਟਰੂਮੈਂਟ ਜਿਹੜੇ ਪਿੱਛੇ ਵੱਜਦੇ ਹਨ ਉਹ ਕਈ ਵਾਰ ਗਲਤ ਪ੍ਰਕਾਰ ਦੇ ਨਾਲ ਵੱਜਦੇ ਹਨ ਕਿ ਉਹਦਾ ਕੋਈ ਮਤਲਬ ਨਹੀਂ ਬਣਦਾ ਹੈ ਤਾਂ ਕਰਕੇ ਇਹ ਚੀਜ਼ਾਂ ਤੋਂ ਆਪਾ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਗ ਗਾਇਕਾਂ ਦੀ ਇਹ ਗਲਤੀਆਂ ਤੋਂ ਆਪਾਂ ਨੂੰ ਬਚਣਾ ਚਾਹੀਦਾ ਹੈ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਧਿਆਨ ਮਹੱਤਵਪੂਰਨ ਤਰੀਕੇ ਨਾਲ ਧਿਆਨ ਰੱਖਣਾ ਚਾਹੀਦਾ ਹੈ